ਕਿਉਂਕਿ ਮੈਂ ਰੂਪਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਅਤੇ ਇੱਥੋਂ ਦੀ ਵਸੋਂ ਵੀ ਘੱਟ ਹੈ ਅਤੇ ਦੇਖਿਆ ਜਾਵੇ ਕਿ ਹੋਰ ਜ਼ਿਲ੍ਹਿਆਂ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਜੰਗਲੀ ਖੇਤਰ ਵੀ ਇੱਥੇ ਵੱਧ ਪਾਇਆ ਜਾਂਦਾ ਹੈ ਰੂਪਨਗਰ ਜ਼ਿਲ੍ਹੇ ਵਿੱਚ ਮੈਨੂੰ ਅਨੰਦਪੁਰ ਸਾਹਿਬ ਸ਼ਹਿਰ ਸਭ ਤੋਂ ਮਨ ਭਾਉਂਦਾ ਹੈ ਕਿਉਂਕਿ ਇੱਥੇ ਗੁਰਦੁਆਰਿਆਂ ਦੀ ਫੀ ਫਿਜ਼ਾ ਨਾਲ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ ਮੈਂ ਆਪਣੇ ਵਿਹਲ ਦੇ ਸਮੇਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚ ਕੇ ਗੁਰਦੁਆਰਾ ਕੇਸਗੜ੍ਹ ਸਾਹਿਬ ਵਿੱਚ ਨਤਮਸਤਕ ਹੁੰਦਾ ਹਾਂ ਅਤੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ